ਖੁਰਾਕ ਦੋ ਪ੍ਰਕਾਰ ਦੀ ਹੁੰਦੀ ਹੈ ਮਾਸਾਹਾਰੀ ਅਤੇ ਸ਼ਾਕਾਹਾਰੀ ਹਰੇਕ ਵਿਅਕਤੀ ਆਪਣੀ ਪਸੰਦ ਅਤੇ ਸੁ ਸੁਆਦ ਅਨੁਸਾਰ ਖੁਰਾਕ ਲੈਂਦਾ ਹੈ ਖੁਰਾਕ ਦੇ ਵਿੱਚ ਹਰੇਕ ਪ੍ਰਕਾਰ ਦਾ ਅਤੇ ਪੋਸ਼ਿਕ ਤੱਤ ਵਿਟਾਮਿਨ ਅਤੇ ਫ ਫਾਈਬਰ ਹੁੰਦੇ ਹਨ ਸੰਤੁਲਿਕ ਖੁਰਾਕ ਉਸ ਨੂੰ ਕਹਿੰਦੇ ਹਨ ਜਿਸ ਦੇ ਵਿੱਚ ਸਾਡੇ ਸਰੀਰ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਵਾਲੇ ਤੱਤ ਹੁੰਦੇ ਹਨ ਜਿਵੇਂ ਕਿ ਕਾਰਬੋਹਾਈਡ੍ਰੇਸ ਪ੍ਰੋਟੀਨ ਚਰਬੀ ਖਨਿਜ ਪਦਾਰਥ ਅਤੇ ਵਿਟਾਮਿਨ ਲ ਲੋੜ ਅਨੁਸਾਰ ਸਾਡੇ ਸਰੀਰ ਦੀ ਤੰਦਰੁਸਤੀ ਲਈ ਇਹਨਾਂ ਸਾਰੇ ਤੱਤਾਂ ਦਾ ਭਰਪੂਰ ਮਾਤਰਾ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਇਹ ਸਾਰੇ ਪਦਾਰਥ ਸਾਨੂੰ ਭਿੰਨ ਭਿੰਨ ਪ੍ਰਕਾਰ ਦੇ ਸ਼ਾਕਾਹਾਰੀ ਅਤੇ ਮਾਸਾਹਾਰੀ ਭੋਜਨ ਵਿੱਚੋਂ ਪ੍ਰਾਪਤ ਹੁੰਦੇ ਹਨ ਕਾਰਬੋਹਾਈਡਰੇਟ ਸਾਨੂੰ ਚੀਨੀ ਗੁੜ ਸ਼ਹਿਦ ਆਲੂ ਵਰਗੇ ਪਦਾਰਥਾਂ ਵਿੱਚ ਪ੍ਰਾਪਤ ਹੁੰਦੇ ਹਨ ਇਸ ਤੋਂ ਬਿਨਾਂ ਸਰੀਰ ਦੇ ਵਿੱਚ ਕੰਮ ਕਰਨ ਦੀ ਸ਼ਕਤੀ ਨਹੀਂ ਮਿਲਦੀ ਪ੍ਰੋਟੀਨ ਸਾਡੇ ਸਰੀਰ ਦਾ ਵਿਕਾਸ ਕਰਦਾ ਹੈ ਪ੍ਰੋਟੀਨ ਸਾਨੂੰ ਦੁੱਧ ਪਨੀਰ ਮਾਸਾਹਾਰੀ ਅੰਡੇ ਅਤੇ ਦਾਲਾਂ ਤੋਂ ਪ੍ਰਾਪਤ ਹੁੰਦਾ ਹੈ ਚਰਬੀ ਸਾਨੂੰ ਗਰਮੀਆਂ ਸ ਗਰਮੀ ਸਰਦੀਆਂ ਦੀਆਂ ਸੱਟਾਂ ਤੋਂ ਬਚਾਉਂਦੀ ਹੈ ਇਹ ਸਾਨੂੰ ਤੇਲ ਘਿਓ ਅਤੇ ਮੱਖਣ ਤੋਂ ਮਿਲਦੀ ਹੈ ਹਰੀ ਸਬਜ਼ੀਆਂ ਹਰੀ ਸਬਜ਼ੀਆਂ ਦਾ ਸਾਡੇ ਜੀਵਨ ਵਿੱਚ ਬਹੁਤ ਯੋਗਦਾਨ ਹੈ ਹਰੀ ਸਬਜ਼ੀਆਂ ਨਾਲ ਸਰੀਰ ਵਿੱਚ ਤਾਕਤ ਆਉਂਦੀ ਹੈ ਅਤੇ ਸਰੀਰ ਤੰਦਰੁਸਤ ਰਹਿੰਦਾ ਹੈ